ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਠੀਕ ਹੋ ਵਧੀਆ ਵਧੀਆ ਹੋਰ ਸੁਣਾਓ ਘਰ ਬਾਰ ਠੀਕ ਠਾਕ ਸਾਰਾ ਦੱਸੋ ਅੱਛਾ ਜੀ ਬਈ ਦੇਖੋ ਵੀਰ ਜੀ ਸਕੂਲ ਤਾਂ ਆਪਣੀ ਸ਼ਹਿਰ ਚ ਸਾਰੇ ਵਧੀਆ ਨੇ ਹਨਾ ਜਿਹੜੇ ਸਕੂਲ 'ਚ ਮੇਰੇ ਵਿੱਚ ਪੜ੍ਦੇ ਪਏ ਡੀਸੀ ਮਾਡਲ ਸਕੂਲ ਦਾ ਇੱਕ ਤੁਸੀਂ ਕਹਿ ਦੋ ਵੀ ਸਭ ਤੋਂ ਬੈਸਟ ਸਕੂਲ ਠੀਕ ਹੈ ਨਾ ਪ੍ਰੀਤ ਜੀ ਜਿਵੇਂ ਕਿ ਐਚਐਮਡੀਏ ਵੀ ਹੈਗਾ ਇੱਕ ਇੱਕ ਦਿੱਲੀ ਪਬਲਿਕ ਸਕੂਲ ਹੈਗਾ ਆਪਣੇ ਠੀਕ ਹੈ ਨਾ ਇੱਕ ਆਪਣੇ ਐਚਐਮਡੀਏ ਵੀ ਹੈਗਾ ਸਕੂਲ ਜੇ ਤੁਸੀਂ ਪੈਸਾ ਲਾਣਾ ਹਨਾ ਤੇ ਤੁਸੀਂ ਇਹ ਤੁਸੀਂ ਡੀਸੀ ਮਾਡਲ ਸਕੂਲ 'ਚ ਪਾਵੋ ਟੀਚਰ ਸਭ ਤੋਂ ਵਧੀਆ ਨੇ ਉਥੇ ਐਕਟੀਵਿਟੀਜ ਸਭ ਤੋਂ ਵਧੀਆ ਕਿਉਂ ਕਰਾਈਆਂ ਜਾਂਦੀਆਂ ਹਨਾ ਪਤਾ ਇੰਫਰਾਸਟਰਕਚਰ ਸਭ ਤੋਂ ਵਧੀਆ ਉਹਦੀ ਐਜੂਕੇਸ਼ਨ ਲੈਵਲ ਆ ਐਜੂਕੇਸ਼ਨ ਲੈਵਲ ਹੈ ਉਹ ਬਹੁਤ ਹੀ ਵਧੀਆ

ਨਹੀਂ ਨਹੀਂ ਉਹ ਪੜ੍ਹਾਉਂਦੇ ਉਸ ਤਰੀਕੇ ਨੇ ਅਸੀਂ ਪੜਨ ਲੱਗ ਜਾਂਦੇ ਆ ਉਹਦਾ ਰਿਜਲਟ ਤੁਸੀਂ ਮੰਨੋਗੇ ਇਨਾ ਕਿਉਂ ਵਧੀਆ ਕਿ ਕੰਮ ਸੇ ਕਮ ਹਰ ਬੱਚਾ ਨਾਇੰਟੀ ਪਰਸੇੰਟ ਲੈ ਕੇ ਤਾਂ ਪਾਸ ਹੀ ਹੁੰਦਾ ਹਾਂਜੀ ਹਾਂਜੀ ਹੁਣ ਸਾਡੇ ਬੱਚੇ ਨੇ ਜਿਹੜੇ ਉਹ ਮੇਰੀ ਇੱਕ ਦੂਸਰੀ ਕਲਾਸ 'ਚ ਪੜਦੀ ਹੈ ਤੇ ਜਿਹੜਾ ਆਪਣਾ ਲੜਕਾ ਉਹ ਅੱਠਵੀਂ 'ਚ ਹੈ ਏਟਥ 'ਚ ਤੇ ਦੋਵੇਂ ਹੀ ਨਾਇੰਟੀ ਫ਼ੈਈਵ ਪਰਸੇੰਟ ਤੋਂ ਉੱਤੇ ਨੰਬਰ ਲੈ ਕੇ ਆਉਂਦੇ ਹਰ ਸਾਲ ਉਹਨਾਂ ਦੀ ਤੁਸੀਂ ਇੰਗਲਿਸ਼ ਸੁਣੋਗੇ ਇੰਗਲਿਸ਼ ਸੁਣੋਗੇ ਤੇ ਇੰਗਲਿਸ਼ ਉਹਨਾਂ ਦੀ ਬਹੁਤ ਵਧੀਆ ਬਾਕੀ ਗੱਲ ਕਿ ਜਿਵੇਂ ਆਪਣੇ ਆਂਡ ਗੁਆਡ ਚ ਬੱਚੇ ਦਿੱਲੀ ਪਬਲਿਕ ਸਕੂਲ ਵੀ ਪੜ੍ਹਦੇ ਆ ਉਹਦੀ ਪੀਸ ਥੋੜੀ ਘੱਟ ਹੈ ਡੀਸੀ ਮਾਡਲ ਨਾਲੋਂ ਪਰ ਉਸ ਸਟਡੀ ਉਹਦੀ ਵੀ ਬਹੁਤ ਜਿਆਦੀ ਵਧੀਆ ਹਾਂ ਇਹ ਬਹੁਤ ਵਧੀਆ ਇੱਕ ਤੁਹਾਨੂੰ ਉਥੇ ਫੈਸਿਲਿਟੀ ਮਿਲ ਜਾਏਗੀ ਕਿ ਉਹ ਬੱਸ ਥੋੜਾ ਦੂਰ ਹੈ ਫਿਰੋਜ਼ਪੁਰ ਸ਼ਹਿਰ ਤੋਂ ਥੋੜਾ ਤੇ ਉਹ ਬੱਸ ਤੁਹਾਨੂੰ ਬੱਚਿਆਂ ਨੂੰ ਲੈ ਕੇ ਆਏਗੀ ਤੇ ਬਾਕੀ ਛੱਡ ਕੇ ਜਾਏਗੀ ਸਕੂਲ ਇੰਗਲਿਸ਼ 'ਚ ਬਹੁਤ ਹਾਂਜੀ ਹਾਂਜੀ ਨਹੀਂ ਨਹੀਂ ਕੰਟਰੋਲ ਦੇਖੋ ਖੁਦ ਕਰ ਲੈਣਗੇ ਬੱਚਿਆਂ ਤੇ ਉਹ ਡਰਾਉਂਦੇ ਨਹੀਂ ਬੱਚਿਆਂ ਨੂੰ ਕੁੱਟਦੇ ਨਹੀਂ ਆ ਬਾਕੀ ਹਾਂ ਅੱਜ ਕੱਲ ਮੈਂ ਇੱਕ ਗੱਲ ਦੇਖੀ ਕਿ ਅੱਜਕੱਲ ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹਨਾਂ ਦੀ ਸਥਿਤੀ ਵੀ ਬਹੁਤ ਵਧੀਆ ਹੋਈ ਜਾ ਰਹੀ ਹੈ ਤਕ ਮੈਂ ਵੇਖ ਰਿਹਾ ਉਹਨਾਂ ਨੂੰ ਸਰਕਾਰੀ ਸਕੂਲਾਂ ਨੂੰ ਉਹਨਾਂ ਦੀ ਸਥਿਤੀ ਵੀ ਬਹੁਤ ਵਧੀਆ ਹੋ ਰਹੀ ਹੈ ਬਾਕੀ ਹਾਂ ਆਪਾਂ ਆਪਣੇ ਬੱਚਿਆਂ ਨੂੰ ਮੈਂ ਤਾਂ ਇੱਕੋ ਗੱਲ ਕਹਿੰਦੇ ਕਿ ਵਧੀਆ ਸਕੂਲਾਂ ਚ ਪਾਈਏ ਕਿਉਂਕਿ ਜੇ ਆਪਣਾ ਫਿਊਚਰ ਨਹੀਂ ਬਣਿਆ ਆਪਾਂ ਨਹੀਂ ਕੁਝ ਬਣ ਸਕੇ ਕੀ ਪਤਾ ਉਹ ਬਣ ਜਾਣ

ਕੋਈ ਗੱਲ ਨਹੀਂ ਤੇ ਤੁਸੀਂ ਸਕੂਲ ਦਾ ਪਤਾ ਕਰਨ ਜਾਣਾ ਤੇ ਮੈਨੂੰ ਕੋਈ ਨੀ ਨਾਲ ਲੈਂਦੇ ਜਾਇਓ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਚੱਲ ਪਾਂਗਾ ਆਪਾਂ ਸਾਰੀ ਇਨਕੁਾਇਰੀ ਕਰ ਆਵਾਂਗੇ ਇੰਨੀ ਫੀਸ ਹੈ ਕਿ ਮੰਗਦੇ ਪਏ ਆ ਮਾਂ ਪੇ ਇੱਕ ਗੱਲ ਉੱਥੇ ਮਾ ਪਿਓ ਵੀ ਪੜੇ ਲਿਖੇ ਮੰਗਦੇ ਹੋ ਹਾਂਜੀ ਮਾਂ ਪੇਓ ਪੜੇ ਲਿਖੇ ਮੰਗਦੇ ਆ ਕਿ ਮਾਂ ਪਿਓ ਨੇ ਕਮ ਸੇ ਕਮ ਬੀਏ ਬੀਏ ਕੀਤੀ ਹੋਵੇ ਇਹ ਉਹਨਾਂ ਦੀ ਫੋਰਮੈਲਟੀ ਹੈਗੀ ਹੈ ਬਾਕੀ ਕੋਈ ਗੱਲ ਨਹੀਂ ਆਪਾਂ ਉੱਥੇ ਜਾ ਕਰ ਲਾਂਗੇ ਜੇ ਕੁਛ ਨਾ ਕੁਛ ਹੁੰਦਾ ਹੋਇਆ ਜਾਂ ਕੋਈ ਸਿਫਾਰਿਸ਼ ਦਾ ਸਿਸਟਮ ਚਲਦਾ ਹੋਇਆ ਵੀ ਚਲਾਦਾਗੇ ਹਾਂਜੀ ਹਾਂਜੀ

ਨਹੀਂ ਨਹੀਂ ਕੋਈ ਗੱਲ ਨਹੀਂ ਵੀਰ ਜੀ ਜਦੋਂ ਮਰਜ਼ੀ ਬਾਕੀ ਟੈਨਸ਼ਨਾਂ ਲਓ ਜੇ ਜਾਣਾ ਵੀ ਮੈਂ ਨਾਲ ਲੈ ਜਾੋਓ ਚਲੋ ਕੋਈ ਗੱਲ ਨਹੀਂ ਮੈਨੂੰ ਕਾਲ ਕਰ ਦਿਓ ਜਿੱਦਣ ਜਾਣਾ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ ਓਕੇ ਜੀ ਓਕੇ ਓਕੇ ਬਾਈ